ਭੰਗੜੇ ਦੀ ਡਰੈਸ ਅਲੱਗ ਹੀ ਹੁੰਦੀ ਹੈ ਕੀ ਜੋ ਉਹਨੂੰ ਵੇਖਦਾ ਹੈ ਉਹ ਆਪਣੇ ਆਪ ਅਕਰਸ਼ਿਤ ਹੋ ਜਾਂਦਾ ਹੈ ਜਿਵੇਂ ਕੀ ਦੋਤੀ ਅਤੇ ਕੁੜਤਾ ਦੋਤੀ ਅਤੇ ਕੁੜਤਾ ਅਤੇ ਉੱਤੇ ਪੱਗ ਹੁੰਦੀ ਹੈ ਤੇ ਨਾਲੇ ਇੱਕ ਇੱਕ ਡੰਡੀ ਡੰਡਾ ਹੁੰਦਾ ਹੈ ਜਿਸ ਇੱਕ ਤੇ ਪੈਰਾਂ ਦੇ ਵਿੱਚ ਜੁੱਤੀ ਹੁੰਦੀ ਹੈ ਬੰਦਾ ਵੇਖਦਾ ਹੈ ਤਾਂ ਉਹਨੂੰ ਵੇਖਦਾ ਹੀ ਰਹਿੰਦਾ ਹੈ ਤੇ ਉਹ ਆਪਣੀ ਸਾਰੀ ਪੁਸ਼ਾਕਾਂ ਪੂਰੀਆਂ ਤਿਆਰ ਹੁੰਦਾ ਹੈ ਤਾਂ ਉਸ ਦੀ ਪੁਸ਼ਾਕ ਸਾਰਿਆਂ ਤੋਂ ਵੱਖਰੀ ਹੁੰਦੀ ਹੈ ਉਸ ਦਰਸ਼ਕ ਦੇਖ ਕੇ ਆਪਣੇ ਆਪ ਹੀ ਉਹਨਾਂ ਵੱਲ ਆਕਰਸ਼ਿਤ ਹੋ ਜਾਉਂਦੇ ਹਨ ਕੀ ਕੀ ਇਹ ਕਿੰਨੇ ਸੋਹਣੇ ਉਹਨਾਂ ਦਾ ਅਲੱਗ ਹੀ ਚਿਹਰੇ ਤੇ ਰੋਹਬ ਜਿਹਾ ਦਿਖਾਈ ਦਿੰਦਾ ਹੈ ਉਹ ਡਾਂਸ ਉਹ ਨੱਚਦੇ ਹੈ ਤਾਂ ਜਦੋਂ ਦਿਲ ਅਪਨ ਖੁਸ਼ ਹੋ ਜਾਉਂਦਾ ਹੈ ਤੇ ਤੇ ਜੋ ਦੇਖਦੇ ਹੈ ਦਰਕਸ਼ਤ ਉਹ ਆਪਣੇ ਆਪ ਰੋਲਾ ਪਾਉਣ ਲੱਗ ਜਾਉਂਦੇ ਹਨ ਤੇ ਉਹਨਾਂ ਨੂੰ ਉਤਸ਼ਾਹਿਤ ਕਰਦੇ ਹਨ ਕੀ ਔਰ ਡਾਂਸ ਕਰੋ ਉਹਨਾਂ ਦੀ ਪੋਸ਼ਾਕ ਬਹੁਤ ਵੱਖਰੀ ਤੇ ਅਲੱਗ ਦਿਖਾਈ ਦਿੰਦੀ ਹੈ ਕਿਉਂਕੀ ਭੰਗੜ੍ਹਾ ਇੱਕ ਅਜਿਹਾ ਹੈ ਜਿਸ ਨਾਲ ਜੋ ਕੀ ਪੰਜਾਬੀਆਂ ਦੀ ਸ਼ਾਨ ਹੁੰਦੀ ਹੈ ਭੰਗੜੇ ਭੰਗੜਾ ਲੋਕੀ ਬਹੁਤ ਕਰਦੇ ਹਨ